ਜਦੋੇਂ ਵੀ ਅਸੀਂ ਆਪਣੇ ਪਿੰਡ ਵਿੱਚ ਆਪਣਾ ਘਰ ਬਣਾਉਂਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਉਹ ਜਗ੍ਹਾ ਸਮਤਲ ਹੋਣੀ ਚਾਹੀਦੀ ਹੈ ਅਤੇ ਸਾਡਾ ਜੋ ਵੀ ਆਂਢ ਗੁਆਂਢ ਹੈ ਪੜੋਸ ਹੈ ਸਭ ਤੋਂ ਵਧੀਆ ਹੋਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਦੇਖਣਾ ਚਾਹੀਦਾ ਹੈ ਕਿ ਸਾਡੇ ਘਰ ਦੇ ਨੇੜੇ ਕੋਈ ਜੰਗਲੀ ਜੀਵ ਜਾਨਵਰ ਨਾ ਆਉਂਦਾ ਹੋਵੇ ਤਾਂ ਕਿ ਜੋ ਸਾਡੇ ਘਰ ਜਾਂ ਸਾਡੇ ਕਿਸੇ ਫੈਮਲੀ ਮੈਂਬਰ ਦਾ ਨੁਕਸਾਨ ਉਹ ਨਾ ਕਰ ਸਕੇ ਇਸ ਤਰ੍ਹਾਂ ਸਾਨੂੰ ਦੇਖਣਾ ਚਾਹੀਦਾ ਹੈ ਆਪਣੇ ਫੈਮਲੀ ਦੇ ਮੈਂਬਰਾਂ ਦੇ ਐਕੋਰਡਿੰਗ ਸਾਨੂੰ ਆਪਣੇ ਘਰ 'ਚ ਕਮਰੇ ਬਣਾਉਣੇ ਚਾਹੀਦੇ ਹਨ ਅਤੇ ਦੋ ਰਸੋਈਆਂ ਬਣਨੀਆਂ ਚਾਹੀਦੀਆਂ ਇੱਕ ਕੱਚੀ ਰਸੋਈ ਔਰ ਇੱਕ ਪੱਕੀ ਰਸੋਈ ਅਤੇ ਇਸ ਦੇ ਨਾਲ ਹੀ ਜਿਵੇਂ ਕਿ ਕੱਚੀ ਰਸੋਈ ਦੇ ਵਿੱਚ ਆਪਾਂ ਚੁੱਲ੍ਹਾ ਬਾਲ਼ ਸਕਦੇ ਹਾਂ ਲੱਕੜਾਂ ਲਾ ਕੇ ਇਵੇਂ ਹੀ ਅਤੇ ਜੋ ਅੱਜ ਦਾ ਦਾ ਟਾਈਮ ਹੈ ਤਾਂ ਉਸ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਮਕਾਨ ਦੇਖਣ ਨੂੰ ਮਿਲਦੇ ਹਨ ਬਹੁਤ ਹੀ ਜ਼ਿਆਦਾ ਵਧੀਆ ਕੋਠੀਆਂ ਆਲੇ ਹੁੰਦੇ ਨੇ ਕੋਈ ਵਿੱਚ ਕੱਚੇ ਵੀ ਹੁੰਦੇ ਨੇ ਅੱਜ ਕੱਲ੍ਹ ਜ਼ਿਆਦਾਤਰ ਨਵੀਂ ਜਨਰੇਸ਼ਨ ਹੈ ਜੋ ਸ਼ਹਿਰ ਦੇ ਵਿੱਚ ਰਹਿਣਾ ਪਸੰਦ ਕਰਦੀ ਹੈ ਫਲੈਟਾਂ ਦੇ ਵਿੱਚ ਰਹਿਣਾ ਪਸੰਦ ਕਰਦੀ ਹੈ ਤਾਂ